ਸਾਡੇ ਇਲਾਕੇ ਵਿੱਚ ਕਈ ਪ੍ਰਸਿੱਧ ਧਾਰਮਿਕ ਸਥਾਨ ਹਨ ਪਰ ਸਾਡੇ ਇਲਾਕੇ ਵਿੱਚ ਸਭ ਤੋਂ ਪ੍ਰਸਿੱਧ ਸਥਾਨ ਚੱਪੜਚਿੜੀ ਹੈ ਚੱਪੜਚਿੜੀ ਵਿੱਚ ਬ ਦੂਰ ਦੂਰ ਤੋਂ ਸੈਲਾਨੀ ਇੱਥੇ ਘੁੰਮਣ ਫਿਰਨ ਆਉਂਦੇ ਹਨ ਇੱਥੇ ਬੰਦਾ ਸਿੰਘ ਬਹਾਦਰ ਦੇ ਲੜਾਈ ਦੇ ਪੁਤਲੇ ਬਣੇ ਹੋਏ ਹਨ ਇੱਥੇ ਦਾ ਇਤਿਹਾਸ ਬਹੁਤ ਹੀ ਜ਼ਿਆਦਾ ਡੂੰਗਾ ਹੈ ਇੱਥੇ ਮਹਾ ਬੰਦਾ ਸਿੰਘ ਬਹਾਦਰ ਅਤੇ ਬੰਦਾ ਸਿੰਘ ਬਹਾਦਰ ਅਤੇ ਮੁਗਲ ਫੌਜਾਂ ਵਜ਼ੀਰ ਖ਼ਾਂ ਵਿੱਚ ਲੜਾਈ ਲੜੀ ਗਈ ਸੀ ਇਹ ਲੜਾਈ ਬਾਰ੍ਹਾਂ ਮਈ ਸਤਾਰ੍ਹਾਂ ਸੌ ਦਸ ਈਸਵੀ ਨੂੰ ਲੜੀ ਗਈ ਸੀ ਇਸ ਇਸ ਯੁੱਧ ਪਿੱਛੇ ਇੱਕ ਬੜਾ ਹੀ ਬੜਾ ਹੀ ਵੱਡਾ ਕਾਰਨ ਸੀ ਪਹਿਲਾਂ ਕਾਰਨ ਤਾਂ ਇਹ ਸੀ ਕਿ ਵਜ਼ੀਰ ਖ਼ਾਂ ਵਜ਼ੀਰ ਖ਼ਾਂ ਲੋਕਾਂ 'ਤੇ ਬਹੁਤ ਹੀ ਜ਼ਿਆਦਾ ਅੱਤਿਆਚਾਰ ਕਰਦਾ ਸੀ ਉਹ ਉਹਨਾਂ 'ਤੇ ਬਹੁਤ ਜ਼ੁਲਮ ਕਰਦਾ ਸੀ ਅਤੇ ਦੂਜਾ ਕਾਰਨ ਇਹ ਹੈ ਕਿ ਉਹਨਾਂ ਕੀ ਵ ਵਜ਼ੀਰ ਖ਼ਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਮਾਸੂਮ ਮਾਸੂਮ ਸਾਹਿਬਜ਼ਾਦੇ ਸਾਹਿਬਜ਼ਾਦਿਆਂ ਨੂੰ ਫਤਿ ਬ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਜਿੰਦਾ ਜ਼ਿੰਦਾ ਦੀਵਾਰ ਵਿੱਚ ਚਿਣਵਾ ਦਿੱਤਾ ਸੀ ਜਿਸ ਕਾਰਨ ਇਹ ਖਬਰ ਇਸ ਇਸ ਦੀ ਖਬਰ ਸੁਣ ਕੇ ਬੰਦਾ ਸਿੰਘ ਬਹਾਦਰ ਦਾ ਖੂਨ ਖੌਲ ਉੱਠਿਆ ਜਿਸ ਕਾਰਨ ਬੰਦਾ ਸਿੰਘ ਬਹਾਦਰ ਨੇ ਉਹਨਾਂ ਸਾਹਿਬਜ਼ਾਦਿਆਂ ਦਾ ਬਦਲਾ ਲੈਣ ਲਈ ਵ ਵਜ਼ੀਰ ਖ਼ਾਂ ਨੂੰ ਮੌਤ ਦੇ ਘਾਟ ਉਤਾਰਨ ਦਾ ਫੈਸਲਾ ਕਰ ਲਿਆ ਬੰਦਾ ਸਿੰਘ ਬਹਾਦਰ ਅਤੇ ਵਜ਼ੀਰ ਖ਼ਾਂ ਦੀ ਫਤ ਸਰਹੰਦ ਤੋਂ ਦੂਰ ਚੱਪੜਚਿੜੀ ਵਿਖੇ ਲੜਾਈ ਹੋਈ ਸੀ